ਹੈਲੋ ਹਾਂਜੀ ਭਾਅ ਜੀ ਕੀ ਹਾਲ ਹੈ ਬਾ ਵਧੀਆ ਵਧੀਆ ਤੂੰ ਦੱਸ ਹੋਰ ਕੀ ਬਣਦਾ ਬਾ ਵਧੀਆ ਫ਼ਸਲ ਯਾਰ ਐਤਕੀਂ ਤਾਂ ਕੁਛ ਖ਼ਾਸ ਨਹੀਂ ਯਾਰ ਮੌਸਮ ਕਰਕੇ ਕਣਕ ਨੂੰ ਧੁੰਦ ਵਧੀਆ ਲੱਗੀ ਨਹੀਂ ਹੈਗੀ ਉਸ ਕਰਕੇ ਫਿਰ ਵਧੀਆ ਨਹੀਂ ਲੱਗੀ ਫ਼ਸਲ ਐਤਕੀਂ ਹੁਣ ਝੋਨਾ ਦਾ ਵੀ ਚੋਣਾਂ ਦਾ ਵੀ ਸੀਜ਼ਨ ਆ ਰਿਹਾ ਹੁਣ ਪਤਾ ਨਹੀਂ ਜੇ ਮੀਂਹ ਵੱਧ ਪੈ ਗਿਆ ਤਾਂ ਦਿੱਕਤ ਘੱਟ ਪਿਆ ਤਾਂ ਦਿੱਕਤ ਧਰਤੀ 'ਚੋਂ ਵੀ ਪਾਣੀ ਬਹੁਤ ਨਿਕਲ ਰਿਹਾ ਬਰਕਤ ਜਾ ਰਿਹਾ ਗਰਮੀ ਵੀ ਬਹੁਤ ਵੱਧਦੀ ਜਾ ਰਹੀ ਆ ਕੁਛ ਸਮਝ ਨਹੀਂ ਆ ਰਿਹਾ ਹੁਣ ਕਰੀਏ ਕੀ ਪਹਿਲਾਂ ਹੀ ਟੈਂਸ਼ਨ ਹੋਈ ਪਈ ਆ ਦਿਮਾਗ 'ਤੇ ਹੋਰ ਕੁੜੀ ਦਾ ਵਿਆਹ ਵੀ ਆ ਗਿਆ ਹੁਣ ਕੁਛ ਸਮਝ ਨਹੀਂ ਆ ਰਿਹਾ ਕਿਵੇਂ ਕਰਨਾ ਕੀ ਕਰਨਾ ਕੰਨਾਂ ਨੂੰ ਹੱਥ ਲੱਗੇ ਪਏ ਨੇ ਪੈਸੇ ਹੈ ਨਹੀਂ ਗੇ

ਮੈਨੂੰ ਵੀ ਨਹੀਂ ਕੁਛ ਖ਼ਾਸ ਮੈਨੂੰ ਵੀ ਨਹੀਂ ਖ਼ਾਸ ਮਿਲਿਆ ਰੇਟ ਵੀ ਲਾ ਕੇ ਜਿੰਨੇ ਵੀ ਪੈਸੇ ਮਿਲਦੇ ਨੇ ਉਹਦਾ ਠੇਕੇਦਾਰਾਂ ਨੂੰ ਦੇਣੇ ਪੈ ਜਾਂਦੇ ਨੇ ਠੀਕ ਹੈ ਬਾਕੀ ਜਿਹੜੀ ਪਾਣੀ ਪੂਣੀ ਦੇ ਬਿਲ ਉਹ ਦੇਣੇ ਪੈ ਜਾਂਦੇ ਨੇ ਇਹ ਸਭ ਕੁਛ ਹਾਂ ਉਹੀ ਤਾਂ ਗੱਲ ਹੈ ਹੁਣ ਸਮਝ ਨਹੀਂ ਰਿਹਾ ਕਿੰਨੇ ਕੀ ਕਰਨਾ ਐਧਰੋਂ ਕੁੜੀ ਦਾ ਵੀ ਵਿਆਹ ਕਰਨਾ ਉਹਦੇ ਵੀ ਟੈਂਸ਼ਨ ਹੈ ਲੋਨ ਲੈ ਕੇ ਕੰਮ ਕਰਾਂਗੇ ਲੋਨ ਫਿਰ ਭੁਗਤਾਇਆ ਨਹੀਂ ਜਾਣਾ ਫਿਰ ਉਹੀ ਸਿਰ ਸਿਰ ਸਿਰਦਰਦੀ ਹੋਏਗੀ ਹਾਂ ਹਾਂ

ਹਾਂ ਬਸ ਉਹੀ ਗੱਲ ਆ ਫਿਰ ਇੱਧਰੋਂ ਹੁਣ ਧਰਤੀ ਦੇ ਮੌਸਮ ਦਾ ਵੀ ਨਹੀਂ ਕੁਛ ਪਤਾ ਲੱਗਦਾ ਕਦੋਂ ਕਿੱਥੇ ਪਲਟ ਜਾਵੇ ਜੇ ਹੁਣ ਝੋਨਾ ਲੱਗਾ ਤਾ ਤਾਂ ਹਾਂ ਹਾਂ ਹਾਂ ਪਿਛਲੇ ਸਾਲ ਪਿਛਲੇ ਸਾਲ ਵੀ ਤਾਂ ਆਪਣੀਆਂ ਖ਼ਰਾਬ ਹੋ ਗਈਆਂ ਸਿਗੀਆਂ ਮੀਂਹ ਕਰਕੇ ਅੱਧੀ ਫ਼ਸਲਾਂ ਤਾਂ ਖ਼ਰਾਬ ਹੋ ਗਈਆਂ ਆਪਣੀਆਂ

ਹਾਂ ਹਾਂ ਹੁਣ ਕਰੀਏ ਤਾਂ ਕਰੀਏ ਕੀ ਕੁਛ ਨਹੀਂ ਸਮਝ ਆ ਰਿਹਾ ਹੁਣ ਕੰਨਾਂ ਨੂੰ ਹੱਥ ਲੱਗੇ ਹੋਏ ਨੇ ਬੜੇ ਜ਼ਿੰਮੀਦਾਰਾਂ ਕਹਿਣਾ ਲਿਆਓ ਜੀ ਜੋ ਹੋ ਗਿਆ ਤੁਹਾਡੇ ਪੈਸੇ ਲਿਆਓ ਪਾਣੀ ਦੇ ਪੈਸੇ ਲਿਆਓ ਵਾਰੀਆਂ ਦਾ ਵੀ ਵਾਰੀਆਂ ਵੀ ਬੜੀ ਤੰਗ ਕਰਦੇ ਨੇ ਇਹ ਵਾਰੀ ਟਾਈਮ ਸਿਰ ਆਉਂਦੀ ਨਹੀਂ ਜਦੋਂ ਵਾਰੀ ਆਉਂਦੀ ਆ ਪਾਣੀ ਹੁੰਦਾ ਨਹੀਂ ਲਾਈਟ ਨਹੀਂ ਹੁੰਦੀ ਹਾਂ ਹਾਂ ਹੁਣ ਬਸ ਇਹੀ ਆ ਬੜੀ ਦਿੱਕਤ ਦਿੰਦੇ ਨੇ ਹੁਣ ਤਾਂ ਹੁਣ ਦੇਖਦੇ ਆ ਹੁਣ ਕਿਵੇਂ ਬਣਦਾ ਕੁੜੀ ਦਾ ਵਿਆਹ ਦਾ ਵੀ ਫਿਰ ਜੇ ਨਹੀਂ ਕੁਛ ਬਣਿਆ ਤਾਂ ਕਰਜ਼ਾ ਲੈਣਾ ਪੈਣਾ ਹਾਂ ਕਿਰਾਏ ਬਿਨਾਂ ਰਹਿ ਵੀ ਨਹੀਂ ਸਕਦੇ ਉੱਪਰੋਂ ਜੇ ਮੌਸਮ ਐਤਕੀਂ ਸਾਥ ਦੇ ਗਿਆ ਤਾਂ ਵਧੀਆ ਝੋਨਾ ਫ਼ਸਲ ਨਿਕਲ ਜਾਵੇਗੀ ਰੱਬ ਪਰਮਾਤਮਾ ਸਾਥ ਦੇਵੇ ਜੇ ਬਾਕੀ ਮੌਸਮ ਦਾ ਕੁਛ ਨਹੀਂ ਪਤਾ ਕਿਉਂਕਿ ਅੱਜ ਦੇ ਟਾਈਮ 'ਚ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਹੋ ਰਿਹਾ ਅਤੇ ਤੰਗ ਬੜਾ ਕਰ ਰਿਹਾ ਇਹ ਹਾਂ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਚਲੋ ਮੈਂ ਕਰਦਾ ਫਿਰ ਤੁਹਾਨੂੰ ਸਤਿ ਸ਼੍ਰੀ ਅਕਾਲ